ਮੇਰੇ ਕੋਲ ਪੰਜਾਬੀ ਦੀਆਂ ਕਿਤਾਬਾਂ ਬਹੁਤ ਹੀ ਹਨ ਮੈਨੂੰ ਪੰਜਾਬੀ ਦੀਆਂ ਪੁਰਾਣੀਆਂ ਸਟੋਰੀਆਂ ਬਹੁਤ ਹੀ ਪਸੰਦ ਹਨ ਇਸ ਕਰਕੇ ਮੈਂ ਉਹਨਾਂ ਨੂੰ ਪੜ੍ਹਦੀ ਰਹਿੰਦੀ ਹਾਂ ਅਤੇ ਮੈਨੂੰ ਰਵਿੰਦਰ ਨਾਥ ਜੀ ਦੀ ਸਟੋਰੀ ਬਾਰੇ ਵੀ ਪਤਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਰਵਿੰਦਰ ਨਾਥ ਟੈਗੋਰ ਸੀਗੇ ਉਹ ਆਪਣੀ ਮਾਂ ਬੋਲੀ ਬੰਗਾਲੀ ਨਾਲ ਪਿਆਰ ਕਰਨ ਕਰਕੇ ਗੀਤਕਾਰ ਨਾਟਕਕਾਰ ਚਿੱਤਰਕਾਰ ਕਵੀ ਕਲਾਕਾਰ ਰਵਿੰਦਰ ਨਾਥ ਟੈਗੋਰ ਨੂੰ ਕੌਣ ਨਹੀਂ ਜਾਣਦਾ ਜਦੋਂ ਰਾਸ਼ਟਰੀ ਗਾਨ ਜੋ ਹਰ ਰੋਜ਼ ਸਕੂਲਾਂ ਵਿੱਚ ਗਾਇਆ ਜਾਂਦਾ ਹੈ ਹਰ ਕੌਮੀ ਤਿਓਹਾਰ 'ਤੇ ਜਿਸ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਦੇ ਰਚਣਹਾਰੇ ਦਾ ਨਾਂ ਆਉਂਦਾ ਹੈ ਤਾਂ ਉਸ ਸਮੇਂ ਵੀ ਰਵਿੰਦਰ ਨਾਥ ਟੈਗੋਰ ਨੂੰ ਯਾਦ ਕੀਤਾ ਜਾਂਦਾ ਹੈ ਭਾਰਤ ਮਾਤਾ ਦੇ ਅਜਿਹੇ ਯੋਗ ਪੁੱਤਰ ਜਿਨ੍ਹਾਂ ਭਾਰਤ ਮਾਤਾ ਦੀ ਆਨ ਅਤੇ ਸ਼ਾਨ ਦੀ ਖਾਤਿਰ ਆਪਣਾ ਸਾਰਾ ਜੀਵਨ ਲਗਾ ਦਿੱਤਾ ਉਹਨਾਂ ਨੂੰ ਵਾਰ ਵਾਰ ਨਮਸਕਾਰ ਕਰਨ ਨੂੰ ਜੀਅ ਕਰਦਾ ਹੈ ਰਵਿੰਦਰ ਨਾਥ ਟੈਗੋਰ ਜੀ ਦਾ ਜਨਮ ਸੱਤ ਮਈ ਇੱਕ ਅੱਠ ਅੱਠ ਇੱਕ ਇਸਵੀਂ ਨੂੰ ਬੰਗਾਲ ਦੇ ਮਹਾਂਨਸਰ ਕਲਕੱਤਾ ਵਿਖੇ ਇੱਕ ਬਹੁਤ ਹੀ ਅਮੀਰ ਘਰਾਨੇ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਂ ਸ਼੍ਰੀ ਰਵਿੰਦਰ ਨਾਥ ਠਾਕੁਰ ਸੀ ਜੋ ਬੰਗਾਲ ਦੇ ਪ੍ਰਸਿੱਧ ਬੈਨਰਜੀ ਘਰਾਣੇ ਵਿੱਚੋਂ ਸਨ ਆਪ ਦੇ ਪਿਤਾ ਭਾਵੇਂ ਇੱਕ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੇ ਸਨ ਫਿਰ ਵੀ ਉਹ ਜਾਤ ਪਾਤ ਛੂਤ ਛਾਤ ਜਿਹੇ ਭਰਮਾਂ ਤੋਂ ਦੂਰ ਹੀ ਰਹਿੰਦੇ ਸਨ ਉਹਨਾਂ ਦੇ ਘਰ ਵਿੱਚ ਹਮੇਸ਼ਾ ਪ੍ਰਾਥਨਾ ਅਤੇ ਭਜਨ ਬੰਦਗੀ ਦਾ ਮਾਹੌਲ ਬਣਿਆ ਹੀ ਰਹਿੰਦਾ ਸੀ ਇਹਨਾਂ ਸਭ ਗੱਲਾਂ ਦਾ ਰਵਿੰਦਰ ਨਾਥ 'ਤੇ ਬਹੁਤ ਅਸਰ ਪਿਆ ਘਰ ਦੇ ਧਾਰਮਿਕ ਮਾਹੌਲ ਦਾ ਹੀ ਅਸਰ ਸੀ ਕਿ ਆਪ ਆਪਣੇ ਪਿਤਾ ਜੀ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ ਜਿਸ ਨੂੰ ਦੇਖ ਕੇ ਆਪ ਬਹੁਤ ਖੁਸ਼ ਹੋਏ ਹੋਰ ਵੀ ਰਵਿੰਦਰ ਨਾਥ ਟੈਗੋਰ ਜੀ ਬਾਰੇ ਬਹੁਤ ਹੀ ਗੱਲਾਂ ਹਨ ਜੋ ਕਿ ਬਹੁਤ ਹੀ ਪ੍ਰਸਿੱਧ ਹਨ ਹੋਰ ਵੀ ਮੈਂ ਇਸ ਤਰ੍ਹਾਂ ਦੀਆਂ ਬਹੁਤ ਹੀ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ਕਿਉਂਕਿ ਮੈਨੂੰ ਇਸ ਤਰ੍ਹਾਂ ਦੀ ਕਿਤਾਬਾਂ ਪੜ੍ਹਨੀਆਂ ਪਸੰਦ ਹਨ ਅਤੇ ਦਿਲਚਸਪ ਲੱਗਦੀਆਂ ਹਨ ਕਿਉਂਕਿ ਇਹ ਸਾਡੀ ਪੰਜਾਬੀ ਦੀ ਪੁਰਾਣੀਆਂ ਕਹਾਣੀਆਂ ਹਨ ਜੋ ਕਿ ਸੱਚ ਹਨ ਇਸ ਕਰਕੇ ਮੈਨੂੰ ਇਹ ਬਹੁਤ ਹੀ ਦਿਲਚਸਪ ਦਿਲਚਸਪ ਲੱਗਦੀਆਂ ਹਨ ਧੰਨਵਾਦ